ਪੰਜਾਬ ਵਿੱਚ ਸਿੱਖਿਆ ਵਿੱਚ ਸੁਧਾਰ ਕਰਨ ਲਈ ਸਰਕਾਰੀ ਪਹਿਲਕਦਮੀਆਂ ਨੀਤੀਆਂ ਬਹੁਤ ਸੀਮਿਤ ਹਨ ਚਾਹੇ ਉਹ ਇਸ ਕਾਰਜ ਲਈ ਫੰਡਿੰਗ ਦੀ ਗੱਲ ਹੋਵੇ ਅਧਿਆਕਪ ਅਧਿਆਪਕ ਸਿਖਲਾਈ ਦੀ ਗੱਲ ਹੋਵੇ ਪਾਠਕ੍ਰਮ ਸੁਧਾਰ ਦੀ ਹੋਵੇ ਵਜੀਫਿਆਂ ਦੀ ਹੋਵੇ ਇਹ ਸਾਧਨ ਇਹ ਸਾਰੀ ਨੀਤੀਆਂ ਜਾਂ ਪਹਿਲਕਦਮੀਆਂ ਜ਼ਰੂਰ ਹਨ ਪਰ ਇਹਨਾਂ ਉੱਤੇ ਹੋਰ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ ਤਾਂ ਕਿ ਸਿੱਖਿਆ ਵਿੱਚ ਸੁਧਾਰ ਕਰਕੇ ਇਸ ਨੂੰ ਗੁਣਵੱਤਾ ਦੇ ਪੱਧਰ 'ਤੇ ਚੰਗੀ ਗੁਣਵੱਤਾ ਦੇ ਪੱਧਰ 'ਤੇ ਆਮ ਵਿਅਕਤੀ ਲਈ ਮੁਹੱਈਆ ਕਰਵਾਇਆ ਜਾ ਸਕੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਜੋ ਹੈ ਅਧਿਆਪਕ ਸਿਖਲਾਈ ਦੇ ਨਾਲ ਨਾਲ ਅਧਿਆਪਕਾਂ ਦੇ ਜੋ ਤਨਖਾਹਾਂ ਹਨ ਉਹ ਬਹੁਤ ਜਿਵੇਂ ਹੁਣ ਠੇਕਾ ਪ੍ਰਣਾਲੀ ਬਹੁਤ ਹੀ ਮੰਦਭਾਗਾ ਚਲਣ ਸ਼ੁਰੂ ਹੋਇਆ ਚਾਹੇ ਉਹ ਸਕੂਲਾਂ ਦੇ ਵਿੱਚ ਹੋਵੇ ਚਾਹੇ ਕਾਲਜਾਂ ਦੇ ਵਿੱਚ ਹੋਵੇ ਅਤੇ ਚਾਹੇ ਉਹ ਯੂਨੀਵਰਸਿਟੀਆਂ ਦੇ ਵਿੱਚ ਹੋਵੇ ਸੋ ਇਹ ਠੇਕਾ ਪ੍ਰਣਾਲੀ ਨੇ ਸਿੱਖਿਆ ਨੀਤੀ ਦਾ ਬੇੜਾ ਗਰਕ ਕਰਨ ਦਾ ਜੋ ਹੈ ਉਹ ਬੀੜਾ ਚੁੱਕਿਆ ਹੋਇਆ ਹੈ ਇਹਦੇ ਨਾਲ ਨੌਜਵਾਨਾਂ 'ਚ ਨਿਰਾਸ਼ਤਾ ਪਾਈ ਜਾ ਰਹੀ ਹੈ ਕਿਉਂਕਿ ਚੰਗਾ ਪੜ੍ਹਨ ਲਿਖਣ ਤੋਂ ਬਾਅਦ ਨਾ ਤਾਂ ਉਹ ਕੋਈ ਸੋਹਣਾ ਸਿੱਖਿਆ ਦੇ ਖੇਤਰ ਵਿੱਚ ਯੋਗਦਾਨ ਪਾ ਸਕਦੇ ਹਨ ਤਾਂ ਉਹਨਾਂ ਨੂੰ ਆਪਣੀ ਜੋ ਰੋਜ਼ਗਾਰ ਦੀ ਹੀ ਚਿੰਤਾ ਜਿਹੜੀ ਰਹਿੰਦੀ ਹੈ ਅਤੇ ਉਹਦੇ ਵਿੱਚ ਗ੍ਰਸੇ ਰਹਿੰਦੇ ਹਨ